ਸਾਡੇ ਰਾਜ ਵਿੱਚ ਬਹੁਤ ਜ਼ਿਆਦਾ ਤਿਉਹਾਰ ਮਨਾ ਬਹੁਤ ਜ਼ਿਆਦਾ ਤਿਉਹਾਰ ਮਨਾਏ ਜਾਂਦੇ ਹਨ ਜਿਸ ਵਿੱਚ ਮੇਨ ਦੀਵਾਲੀ ਵਿਸਾਖੀ ਈਦ ਕ੍ਰਿਸ਼ਮਿਸ ਅਤੇ ਦੁਸਹਿਰਾ ਹਨ ਦੀਵਾਲੀ ਦੀਵਾਲੀ ਮੇਰਾ ਪਸੰਦੀਦਾ ਤਿਉਹਾਰ ਹੈ ਕਿਉਂਕਿ ਇਸ ਵਿੱਚ ਲੋਕ ਆਪਣੇ ਘਰਾਂ ਦੀ ਸਫਾਈਆਂ ਕਰਦੇ ਹਨ ਅਤੇ ਰੰ ਘਰ ਨੂੰ ਰੰਗ ਕਰਦੇ ਹਨ ਅਤੇ ਘਰ ਦੀਆਂ ਸਫਾਈਆਂ ਕਰਦੇ ਹਨ ਅਤੇ ਲੋ ਦੀਵਾਲੀ ਵਾਲੇ ਦਿਨ ਅਲੱਗ ਅਲੱਗ ਤਰ੍ਹਾਂ ਦੇ ਪਕਵਾਨ ਪਕਵਾਨ ਬਣਾਏ ਜਾਂਦੇ ਹਨ ਅਤੇ ਰਾਤ ਨੂੰ ਰਾਤ ਨੂੰ ਰਾਤ ਨੂੰ ਪਕਵਾਨ ਖਾ ਕੇ ਦਿਵਾ ਪਟਾਕੇ ਚਲਾਏ ਜਾਂਦੇ ਹਨ ਅਤੇ ਘਰ ਨੂੰ ਰੁਸ਼ਨਾਇਆ ਜਾਂਦਾ ਹੈ ਲਾਈਟਾਂ ਲੜੀਆਂ ਦੇ ਨਾਲ ਰੁਸ਼ਨਾਇਆ ਜਾਂਦਾ ਹੈ ਈਦ ਮ ਈਦ ਮੁਸਲਮਾਨਾਂ ਦਾ ਤਿਉਹਾਰ ਹੈ ਈਦ ਈਦ ਮਸਜਿਦ ਵਿੱਚ ਮਸਜਿਦ ਵਿੱਚ ਮੁਸਲਮਾਨ ਈ ਪੂਜਦੇ ਹਨ ਪੂਜਦੇ ਹਨ ਕ੍ਰਿਸਮਿਸ ਕ੍ਰਿਸਮਿਸ ਬਹੁ ਕ੍ਰਿਸਮਿਸ ਈਸਾਈਆਂ ਦਾ ਤਿਉਹਾਰ ਹੈ ਜੋ ਬਰ ਜੋ ਕਿ ਬਾਹਰਲੇ ਦੇਸ਼ਾਂ ਵਿੱਚ ਬਹੁਤ ਜ਼ਿਆਦਾ ਮਨਾਇਆ ਜਾਂਦਾ ਹੈ ਵਿਸਾਖੀ ਵਿਸਾਖੀ ਵਿਸਾਖੀ ਵਿਸਾਖੀ ਕਿਸਾਨਾਂ ਦਾ ਕਿਸਾਨਾਂ ਦਾ ਸਭ ਤੋਂ ਵੱਡੀ ਖੁਸ਼ੀ ਵਾਲਾ ਤਿਉਹਾ ਤਿਉਹਾਰ ਹੈ ਇਸ ਦਿਨ ਕਿਸਾਨ ਆਪਣੀ ਖੇ ਉਹਨਾਂ ਦੀ ਫਸਲ ਫਸਲ ਪੱਕ ਕੇ ਤਿਆਰ ਹੋ ਜਾਂਦੀ ਹੈ ਅਤੇ ਇਸ ਦਿਨ ਵਿਸਾਖੀ ਵਾਲ਼ੇ ਦਿਨ ਕਣਕ ਦੀ ਵਢਾਈ ਕੀਤੀ ਜਾਂਦੀ ਹੈ ਅਤੇ ਕ ਕਿਸਾਨਾਂ ਲਈ ਬਹੁਤ ਵਧੀਆ ਤਿਉਹਾਰ ਹੈ ਅਤੇ ਕ ਵਿਸਾਖੀ ਦਾ ਤਿਉਹਾਰ ਜ਼ਿਆਦਾਤਰ ਅਨੰਦਪੁਰ ਵਿਖੇ ਮਨਾਇਆ ਜਾਂਦਾ ਹੈ ਕਿਉਂਕਿ ਗੁਰੂ ਨਾਨਕ ਦੇਵ ਜੀ ਨੇ ਵਿਸਾਖੀ ਵਾਲੇ ਦਿਨ ਹੀ ਅਨੰਦਪੁਰ ਵਿਖੇ ਖਾਲਸਾ ਦੀ ਸਿਰਜਣਾ ਕੀਤੀ ਸੀ ਅਤੇ ਦੁਸਹਿਰਾ ਦਸ ਸਿਰਾਂ ਦੇ ਰਾਵਣ ਨੂੰ ਦੁਸ਼ ਦੁਸਹਿਰਾ ਮਨਾਇਆ ਕੇ ਕੇ ਮਨਾਇਆ ਜਾਂਦਾ ਹੈ ਦੁਸਹਿਰਾ ਦੀਵਾਲੀ ਤੋਂ ਵੀਹ ਦਿਨ ਪਹਿਲਾਂ ਆਉਂਦਾ ਹੈ ਇਹ ਸਾਡੇ ਰਾਜ ਦੇ ਪ੍ਰਮੁੱਖ ਤਿਉਹਾਰ ਹਨ